ਬੋਲੀਵੁੱਡ ਦੇ ਭਾਰਤ ਦੇ ਵਿੱਚ ਫੈਸ਼ਨ ਨੂੰ ਬਹੁਤ ਅਨੁਭਾਵਿਤ ਕੀਤਾ ਜਾਂਦਾ ਹੈ ਬੋਲੀਵੁੱਡ ਦੇ ਭਰਾ ਪਾਤਰ ਜਿਵੇਂ ਹਨ ਮਾਧੁਰੀ ਦੀਕਸ਼ਿਤ ਭਾਗਿਆ ਸ਼੍ਰੀ ਹੇਮਾ ਮਾਲਿਨੀ ਰੇਖਾ ਜਯਾ ਬੱਚਨ ਇਹਨਾਂ ਦੇ ਕੱਪੜੇ ਬਹੁਤ ਸੋਹਣੇ ਹੁੰਦੇ ਹਨ ਅਤੇ ਮੈਂ ਇਹਨਾਂ ਦੇ ਕੱਪੜਿਆਂ ਨੂੰ ਬਹੁਤ ਪ੍ਰਭਾਵਿਤ ਹੋਈ ਇਹਨਾਂ ਦੇ ਪਾਤਰਾਂ ਦੇ ਕੱਪੜੇ ਬਹੁਤ ਸੋਹਣੇ ਹੁੰਦੇ ਹਨ ਅਤੇ ਇਹਨਾਂ ਦੇ ਪ ਪਾਏ ਕੱਪੜੇ ਬਾਰੇ ਮੈਨ ਸਾਰੇ ਭਾਰਤ ਵਿੱਚ ਬਹੁਤ ਚਰਚਾ ਹੈ ਕਿਉਂ ਉਹਨੂੰ ਕਈ ਲੋਕ ਇਨ ਇੰਨਾ ਦੇ ਕੱਪੜੇ ਪਾਏ ਹੋਏ ਦੇਖ ਕੇ ਖੁਦ ਹੀ ਉਨ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਪਸੰਦ ਕਰਦੇ ਹਨ ਇਹ ਸਾੜੀ ਲਹਿੰਗਾ ਸਾ ਸ਼ਰਾਰਾ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਮੈਂ ਵੀ ਇਹਨਾਂ ਨੂੰ ਕੱਪੜੇ ਦੇ ਬਹੁਤ ਪ੍ਰਭਾਵਿਤ ਹੋਈ ਅਤੇ ਮੈਂ ਵੀ ਕਈ ਮੈਂ ਵੀ ਟੀ ਵੀ ਵਿੱਚ ਦੇਖ ਕੇ ਸ ਸਾੜੀ ਸੂਟ ਉਸ ਤਰ੍ਹਾਂ ਦਾ ਪਾਉਣ ਦਾ ਟ੍ਰਾਈ ਕਰਤਾ ਸੀ ਜੋ ਕਿ ਬਹੁਤ ਸੋਹਣੀ ਲੱਗਦੇ ਸਨ ਇਸ ਇੱਕ ਫਿਲਮ ਸੂਈ ਧਾਗਾ ਵਿੱਚ ਜਿਸ ਵਿੱਚ ਇਹ ਫੈਸ਼ਨ ਫੈਸ਼ਨ ਵਿੱਚ ਬਹੁਤ ਚਰਚਾ ਕੀਤੀ ਗਈ ਸੀਗੀ ਇਹ ਪਾਤਰ ਦੇ ਕੱਪੜੇ ਜ਼ਿਆਦਾ ਅਤੇ ਚਮਕਦਾਰ ਵਾਲੇ ਹੁੰਦੇ ਹਨ ਅਤੇ ਸਾਦਗੀ ਵਾਲੇ ਇੱਕ ਹੁੰਦੇ ਹਨ ਇਸ ਲਈ ਮੈਨੂੰ ਇਹਨਾਂ ਦੀ ਫੈਸ਼ਨ ਵਾਲੇ ਕੱਪੜੇ ਬਹੁਤ ਪਸੰਦ ਹਨ ਅਤੇ ਉਸਦੇ ਤਰ੍ਹਾਂ ਹੀ ਕੱਪੜੇ ਮੈਂ ਪਾਉਣਾ ਹੀ ਪਸੰਦ ਕਰਦੀ ਹਾਂ ਅਤੇ ਤਾਂ ਕਿ ਇਹਨਾਂ ਨੂੰ ਕੱਪੜਿਆਂ ਨੂੰ ਬਹੁਤ ਅੱਛੇ ਲੱਗਦੇ ਹਨ